ਸਾਡੇ ਇਲਾਕੇ ਵਿੱਚ ਬਹੁਤ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਹਨ ਜਿਵੇਂ ਕਿ ਸਰਕਾਰੀ ਸਕੂਲ ਲਾਲੋ ਸਕੂਲ ਆਫ ਐਮੀਨੈਂਸ ਜੋ ਕਿ ਪੰਜਾਬ ਸਰਕਾਰ ਵੱਲੋਂ ਹੁਣੇ ਹੁਣੇ ਨਵੇਂ ਸ਼ੁਰੂ ਕੀਤੇ ਗਏ ਨੇ ਇਹ ਵੀ ਇਸ ਵਿੱਚ ਬਹੁਤ ਵਧੀਆ ਸਹੂਲਤਾਂ ਦਿੱਤੀਆਂ ਗਈਆਂ ਵਿਦਿਆਰਥੀਆਂ ਨੂੰ ਵਧੀਆ ਲਾਈਬਾਂ ਮੁਹੱਈਆ ਕਰਾਏ ਗਏ ਨੇ ਵਧੀਆ ਉੱਚ ਪੱਧਰ ਦੀ ਸਿੱਖਿਆ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਗੋਰਮੈਂਟ ਗਰਲ ਸਕੂਲ ਹੈ ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਸ ਸ੍ਰੀ ਨਰਾਇਣ ਸਰਵਿਤਕਾਰੀ ਵਿੱਦਿਆ ਮੰਦਿਰ ਸਰਦਾਰ ਚੇਤਨ ਸਿੰਘ ਸਰਵਿਤਕਾਰੀ ਵਿੱਦਿਆ ਮੰਦਿਰ ਡੀ ਏ ਵੀ ਅਤੇ ਸਕੂਲ ਰੀਸੈਂਸ ਸਕੂਲ ਸਿੰਗਲ ਸਟਾਰ ਇਹ ਬਹੁਤ ਸਾਰੇ ਵੱਡੇ ਵੱਡੇ ਪ੍ਰਾਈਵੇਟ ਸਕੂਲ ਨੇ ਚਲੋ ਇਹਨਾਂ ਦਾ ਤਾਂ ਇੱਕ ਤਰ੍ਹਾਂ ਦਾ ਪ੍ਰਾਈਵੇਟ ਬਿਜ਼ਨਸ ਹੀ ਹੈ ਅਤੇ ਇਹ ਸਕੂਲ ਸਿੱਖਿਆ ਪੱਧਰ ਬਹੁਤ ਵਧੀਆ ਨੇ ਕਿਉਂਕਿ ਇੱਥੇ ਵੈਲ ਕੋਲੀਫਾਈ ਟੀਚਰਾਂ ਨੂੰ ਰੱਖਿਆ ਗਿਆ ਅਤੇ ਵਧੀਆ ਬੱਚਿਆਂ ਨੂੰ ਪੜ੍ਹਾਈ ਦਿੱਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਇਹਨਾਂ ਸਕੂਲਾਂ ਵਿੱਚ ਵਧੀਆ ਪਲੇਅ ਗਰਾਊਂਡ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਓਨਾ ਹੀ ਸ ਰੱਖਿਆ ਜਾਂਦਾ ਜਿੰਨਾ ਕੁ ਪੜ੍ਹਾਈ ਵਿੱਚ ਪੜ੍ਹਾਈ ਵਿੱਚ ਜ਼ੋਰ ਦਿੱਤਾ ਜਾਂਦਾ ਇਸ 'ਤੇ ਸਾਡੇ ਸ਼ਹਿਰ ਦੀ ਜਿਹੜੀ ਸਿੱਖਿਆ ਅਤੇ ਗੁਣਵੱਤਾ ਤੋਂ ਅਸੀਂ ਬਹੁਤ ਖੁਸ਼ ਹਾਂ ਪਰ ਸਾਡੇ ਸ਼ਹਿਰ ਵਿੱਚ ਜਿਹੜੀ ਸਿੱਖਿਆ ਦੇ ਗੁਣਵੱਤਾ ਲਈ ਇਹਨਾਂ ਚਲੋ ਸਕੂਲ ਲੈਵਲ 'ਤੇ ਤਾਂ ਹੈਗੇ ਨੇ ਸਕੂਲ ਪਰ ਅੱਗੇ ਯੂਨੀਵਰਸਿਟੀ ਕੋਲਜ ਵਗੈਰਾ ਨਹੀਂ ਹੈਗੇ ਅਤੇ ਇਸ ਲਈ ਵੱਡੇ ਸ਼ਹਿਰਾਂ ਨੂੰ ਜਿਹੜੇ ਵੱਡੇ ਸ਼ਹਿਰ ਸਾਡੇ ਸ਼ਹਿਰ ਵਿੱਚ ਜਿਹੜੇ ਸਕੂਲ ਨੇ ਬਹੁਤ ਵਧੀਆ ਨੇ ਅਸੀਂ ਅਸੀਂ ਬਾਹਰ ਜਾਣਾ ਜ਼ਿਆਦਾ ਪਸੰਦ ਨਹੀਂ ਕਰਦੇ ਧੰਨਵਾਦ